ਮੇਰੇ ਖਿਆਲ ਵਿੱਚ ਸਾਨੂੰ ਔਰਗੈਨਿਕ ਫਰੂਟ ਔਰਗੈਨਿਕ ਸਬਜ਼ੀਆਂ ਬੀਜਣੀਆਂ ਚਾਹੀਦੀਆਂ ਹਨ ਅਤੇ ਨਵੀਆਂ ਫੈਕਟਰੀਆਂ ਲਗਾਉਣੀਆਂ ਚਾਹੀਦੀਆਂ ਹਨ ਉਹਨਾਂ ਦਾ ਮਾਲ ਫੋਰਨ ਕੰਟਰੀਆਂ ਨਾਲ ਸ਼ੇਅਰ ਕਰਨਾ ਚਾਹੀਦਾ ਹੈ ਉਸ ਤੋਂ ਆਈ ਇਨਕਮ ਸਾਡੀ ਵਿੱਤੀ ਤਰੱਕੀਆਂ ਦੇ ਵਿੱਚ ਫਰਕ ਲਿਆਵੇਗੀ ਇਸ ਤਰ੍ਹਾਂ ਅਸੀਂ ਨਵੀਨਤਾਵਾਂ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਵਿੱਚ ਸਮਰੱਥ ਹੋ ਸਕਦੇ ਹਾਂ